ਮੈਨੂੰ ਕੁਦਰਤ ਨਾਲ ਬਚਪਨ ਤੋਂ ਹੀ ਬਹੁਤ ਮੋਹ ਹੈ ਅਤੇ ਮੈਂ ਜਦ ਵੀ ਕੋਈ ਕੁਦਰਤੀ ਸੁੰਦਰਤਾ ਦੇਖਦੀ ਹਾਂ ਤਾਂ ਉਸਨੂੰ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਹਨਾਂ ਵਿੱਚ ਜਿਵੇਂ ਉੜਦੇ ਅਸਮਾਨ ਵਿੱਚ ਪੰਛੀਆਂ ਦੀ ਫੋਟੋ ਖਿੱਚਣਾ ਮੈਨੂੰ ਪਸੰਦ ਹੈ ਅਤੇ ਉੱਚੇ ਪਹਾੜਾਂ ਵਿੱਚ ਝਰਨਿਆਂ ਵਿੱਚ ਵਗਦੇ ਹੋਏ ਪਾਣੀ ਨੂੰ ਆਪਣੀ ਕੈਮਰੇ ਵਿਤ ਵਿੱਚ ਕੈਦ ਕਰਨਾ ਮੈਨੂੰ ਅੱਛਾ ਲੱਗਦਾ ਹੈ ਅਤੇ ਆਪਣੇ ਆਲੇ ਦੁਆਲੇ ਕਿਸੇ ਵੀ ਤਰੀਕੇ ਦੀ ਪ੍ਰਕਿਰਿਆ ਜਿਵੇਂ ਕਿ ਕੋਈ ਬੱਚਾ ਕਿਸ ਨਾਲ ਕਿਸ ਤਰ੍ਹਾਂ ਆਪਣੇ ਹਾਵ ਭਾਵ ਪ੍ਰਗਟ ਕਰ ਰਿਹਾ ਹੈ ਅਤੇ ਖੇਡ ਰਿਹਾ ਹੈ ਅਤੇ ਆਪਣੇ ਆਪ ਵਿੱਚ ਖੁਸ਼ ਹੋ ਰਿਹਾ ਹੈ ਉਸ ਨੂੰ ਵੀ ਮੈਂ ਆਪਣੀ ਚੰਗੀਆਂ ਫੋਟੋਆਂ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹਾਂ ਅਤੇ ਜਿਵੇਂ ਕੋਈ ਚਾਰ ਬੱਚੇ ਇਕੱਠੇ ਹੋ ਕੇ ਆਪਸ ਵਿੱਚ ਖੇਲਦੇ ਹਨ ਕੋਈ ਸਟਾਪੂ ਖੇਲ੍ਹਦਾ ਹੈ ਕੋਈ ਕਿੱਕਲੀ ਪਾਉਂਦਾ ਹੈ ਉਹਨਾਂ ਨੂੰ ਮੈਂ ਆਪਣੇ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦੀ ਹਾਂ